ਸ਼੍ਰੀਮਾਨ ਜੀ ਮੈਂ ਤੁਹਾਨੂੰ ਪਹਿਲਾਂ ਵੀ ਐਡਰੈਸ ਬਦਲਣ ਦੀ ਅਰਜ਼ੀ ਦੇ ਚੁੱਕੀ ਹਾਂ ਪਰ ਤੁਸੀਂ ਫਿਰ ਵੀ ਮੇਰਾ ਬਿੱਲ ਪੁਰਾਣੇ ਪਤੇ 'ਤੇ ਭੇਜ ਦਿੱਤਾ ਹੈ ਅਤੇ ਇਸ ਕਰਕੇ ਮੇਰੇ ਬਿੱਲ ਭੇਜਣ ਵਿੱਚ ਦੇਰੀ ਹੋ ਗਈ ਜਿਸ ਦੇ ਨਾਲ ਮੈਨੂੰ ਜੁਰਮਾਨਾ ਲੱਗਿਆ ਹੈ ਇਸ ਵਿੱਚ ਮੇਰੀ ਕੋਈ ਵੀ ਗਲਤੀ ਨਹੀਂ ਹੈ ਗਲਤੀ ਸਾਰੀ ਤੁਹਾਡੇ ਵਿਭਾਗ ਦੀ ਹੈ ਇਸ ਲਈ ਮੈਂ ਜੁਰਮਾਨਾ ਨਹੀਂ ਦੇ ਸਕਾਂਗੀ ਮੈਂ ਤੁਹਾਨੂੰ ਇਕ ਇਹ ਹੁਣ ਦੁਬਾਰਾਂ ਅਰਜ਼ੀ ਫਿਰ ਭੇਜ ਰਹੀ ਹਾਂ ਪਲੀਜ਼ ਮੇਰਾ ਐਡਰੈਸ ਇੱਥੇ ਬਦਲ ਦਿੱਤਾ ਜਾਵੇ ਅਤੇ ਨਵਾਂ ਡਰੈਸ ਲਿਖਿਆ ਜਾਵੇ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਉਹ ਸੁਧਰ ਸਕਣ ਮੈਂ ਪਹਿਲਾਂ ਵੀ ਮੈਂ ਪਹਿਲਾਂ ਵੀ ਤੁਹਾਨੂੰ ਇਹ ਤੁਹਾਨੂੰ ਅ ਗੁਜ਼ਾਰਿਸ਼ ਕਰ ਚੁੱਕੀ ਹਾਂ ਕਿ ਮੇਰਾ ਹੈਲਪਲਾਈਨ ਨਾਲ ਸੰਪਰਕ ਕਰਵਾ ਦਿਓ ਪਰ ਮੈਨੂੰ ਕੋਈ ਵੀ ਹੈਲਪਲਾਈਨ ਨਾਲ ਸੰਪਰਕ ਨਹੀਂ ਕਰਵਾ ਰਿਹਾ ਸੀ ਜਿਸ ਕਰਕੇ ਮੇਰਾ ਇਹ ਕੰਮ ਲੇਟ ਹੋ ਰਿਹਾ ਹੈ ਮੈਂ ਅਰਜ਼ੀ ਦਿੱਤੀ ਹੈ ਪਲੀਜ਼ ਉਸ ਅਰਜ਼ੀ ਦੇ ਉੱਤੇ ਮੇਰੇ ਗੌਰ ਫਰਮਾਓ ਅਤੇ ਮੇਰਾ ਅਡਰੈਸ ਘਰ ਦਾ ਬਦਲ ਦਿੱਤਾ ਜਾਵੇ